ਜਿਵੇਂ ਕਿ ਸਾਨੂੰ ਪਤਾ ਹੈ ਕਿ ਅੱਜ ਦਾ ਯੁੱਗ ਤਕਨੀਕੀ ਯੁੱਗ ਹੈ ਅਤੇ ਇਸ ਤਕਨੀਕੀ ਯੁੱਗ ਦੇ ਵਿੱਚ ਬਹੁਤ ਸਾਰੀਆਂ ਐਪਸ ਉਪਲੱਬਧ ਹਨ ਜੋ ਸਾਡੀਆਂ ਮਦਦ ਕਰਦੀਆਂ ਹਨ ਸਭ ਤੋਂ ਪਹਿਲਾਂ ਜਿਵੇਂ ਕਿ ਮੈਂ ਗੱਲ ਕਰਾਂ ਫੇਸਬੁੱਕ ਫੇਸਬੁੱਕ ਦੇ ਜ਼ਰੀਏ ਅਸੀਂ ਆਪਣੇ ਆਲੇ ਦੁਆਲੇ ਕੀ ਕੁਝ ਵਾਪਰ ਰਿਹਾ ਹੈ ਸਭ ਕੁਝ ਦੇਖ ਸਕਦੇ ਹਾਂ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਗੱਲ ਕਰ ਸਕਦੇ ਹਾਂ ਦੂਜੀ ਐਪ ਹੈ ਵਟਸਅਪ ਵਟਸਐਪ ਦੇ ਜ਼ਰੀਏ ਅਸੀਂ ਕਿਸੇ ਨੂੰ ਇਮੇਜਸ ਫੋਟੋਸ ਵੀਡੀਓਜ ਅਤੇ ਜ਼ਰੂਰੀ ਡਾਕੂਮੈਂਟ ਵਗੈਰਾ ਵੀ ਭੇਜ ਸਕਦੇ ਹਾਂ ਤੀਜੀ ਐਪ ਹੈ ਇੰਸਟਾਗਰਾਮ ਇੰਸਟਾਗਰਾਮ ਦੇ ਜ਼ਰੀਏ ਵੀ ਅਸੀਂ ਵੱਖ ਵੱਖ ਪ੍ਰਕਾਰ ਦੀਆਂ ਵੀਡੀਓਜ਼ ਦੇਖ ਸਕਦੇ ਹਾਂ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਗੱਲ ਕਰ ਸਕਦੇ ਹਾਂ ਅਤੇ ਕਈ ਹੋਰ ਐਪਸ ਵੀ ਹਨ ਜਿਵੇਂ ਕਿ ਫਲਿਪਕਾਰਡ ਹੋ ਗਈ ਐਮਾਜ਼ਾਨ ਹੋ ਗਈ ਇਹਨਾਂ ਦੇ ਉੱਪਰ ਅਸੀਂ ਵੱਖ ਵੱਖ ਤਰ੍ਹਾਂ ਦੀਆਂ ਚੀਜ਼ਾਂ ਨੂੰ ਖਰੀਦ ਸਕਦੇ ਹਾਂ ਅਤੇ ਇੱਕ ਹੋਰ ਐਪ ਹੈ ਜੋ ਕਿ ਟੈਲੀਗਰਾਮ ਟੈਲੀਗਰਾਮ ਦੇ ਥਰੂ ਅਸੀਂ ਜ਼ਰੂਰੀ ਨੋਟਸ ਵਗੈਰਾ ਮੰਗਵਾ ਸਕਦੇ ਹਾਂ ਦੋਸਤਾਂ ਮਿੱਤਰਾਂ ਨਾਲ ਗੱਲ ਕਰ ਸਕਦੇ ਹਾਂ ਅਤੇ ਅਸੀਂ ਕੁੱਲ ਮਿਲਾ ਕੇ ਇਹ ਕਹਿ ਸਕਦੇ ਹਾਂ ਕਿ ਇਹ ਸਾਰੀਆਂ ਐਪਸ ਸਾਡੇ ਲਈ ਬਹੁਤ ਹੀ ਜ਼ਰੂਰੀ ਹਨ ਜਿਨ੍ਹਾਂ ਦੇ ਜ਼ਰੀਏ ਅਸੀਂ ਇੱਕ ਦੂਜੇ ਨਾਲ ਸੰਪਰਕ ਦੇ ਵਿੱਚ ਰਹਿੰਦੇ ਹਾਂ ਅਤੇ ਆਪਣੀ ਗੱਲਬਾਤ ਇਕ ਤੋਂ ਦੂਜੀ ਥਾਂ 'ਤੇ ਪਹੁੰਚਾ ਸਕਦੇ ਹਾਂ